ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਪੰਜਾਬ ਦੇ ਵਿੱਚ ਮਹੱਤਵਪੂਰਨ ਨਿਸ਼ਾਨ ਸਮਾਰਕ ਯਾਨੀ ਕਿ ਹੈੈ ਜਿਸ ਤਰ੍ਹਾਂ ਕਿ ਬਹੁਤ ਸਾਰੇ ਹਨ ਇਹਨਾਂ ਵਿੱਚੋਂ ਇੱਕ ਸਾਡਾ ਦਰਬਾਰ ਸਾਹਿਬ ਵੀ ਹੈ ਹਰਿਮੰਦਰ ਦਰਬਾਰ ਸਾਹਿਬ ਉਹ ਗੁਰੂ ਰਾਮਦਾਸ ਦੀ ਨਗਰੀ ਹੈ ਇੱਥੇ ਅਸੀਂ ਜਦੋਂ ਵੀ ਜਾਂਦੇ ਹਾਂ ਸਾਨੂੰ ਸਾਡੀ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਅਤੇ ਅਸੀਂ ਹਮੇਸ਼ਾ ਜਿਸ ਤਰ੍ਹਾਂ ਕਿ ਅਤੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਹਾਂ ਫਿਰ ਅਸੀਂ ਦਰਸ਼ਨ ਦਿਓੜੀ ਜਾਂਦੇ ਹਾਂ ਉੱਥੇ ਵੀ ਸਾਨੂੰ ਬਹੁਤ ਜ਼ਿਆਦਾ ਸਕੂਲ ਮਿਲਦਾ ਹੈ ਫਿਰ ਇਸ ਤਰ੍ਹਾਂ ਅਸੀਂ ਜਲ੍ਹਿਆਂਵਾਲਾ ਬਾਗ ਆਉਂਦੇ ਹਾਂ ਉੱਥੋਂ ਘੁੰਮ ਕੇ ਫਿਰ ਅਸੀਂ ਜਲ੍ਹਿਆਂਵਾਲਾ ਬਾਗ ਆਉਂਦੇ ਹਾਂ ਉਹ ਵੀ ਬਹੁਤ ਵਧੀਆ ਫਿਰ ਇਸ ਤਰ੍ਹਾਂ ਸ਼ਹੀਦਾਂ ਸ਼ਹੀਦ ਜੱਸਾ ਬਾਬਾ ਦੀਪ ਸਿੰਘ ਜੀ ਹੈ ਉਹ ਉੱਥੇ ਲੋਕ ਚੌਪਹਿਰਾ ਸਾਹਿਬ ਪੜ੍ਹਦੇ ਹਨ ਕਹਿੰਦੇ ਹਨ ਕਿ ਚੌਪਹਿਰਾ ਸਾਹਿਬ ਕੱਟਣ ਨਾਲ ਸਭ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਔਰ ਲੋਕ ਫਿਰ ਲੰਗਰ ਛਕਦੇ ਹੈ ਬਹੁਤ ਵਧੀਆ ਉੱਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਫਿਰ ਇਸ ਤਰ੍ਹਾਂ ਸ਼ੀਤਲਾਂ ਮਾਤਾ ਮੰਦਰ ਇਸ ਤਰ੍ਹਾਂ ਕਈ ਜਗ੍ਹਾ ਹੈ ਉੱਥੇ ਐਹ ਮਤਲਬ ਘੁੰਮਣ ਯੋਗ ਔਰ ਫਿਰ ਇਸ ਤਰ੍ਹਾਂ ਸਾਡੇ ਨੇੜੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਹਨੂੰਮਾਨ ਚੌਕ ਹੈ ਉੱਥੇ ਇਹ ਗੁਰੂ ਹੈ ਹਨੂੰਮਾਨ ਚੌਕ ਆ ਉੱਥੇ ਹ ਹਨੂੰਮਾਨ ਜੀ ਦਾ ਮੰਦਰ ਹੈ ਉਹ ਵੀ ਬਹੁਤ ਵਧੀਆ ਪ੍ਰਸਿੱਧ ਮੰਦਰ ਹੈ ਫਿਰ ਇਸ ਤਰ੍ਹਾਂ ਹੀ ਸਾਂ ਸਾਡੇ ਜਹਾਜ਼ ਚੌਕ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਸਿੱਧ ਆ ਜਹਾਜ਼ ਚੌਕ ਹਨੂੰਮਾਨ ਚੌਕ ਵੀ ਬਹੁਤ ਜ਼ਿਆਦਾ ਪ੍ਰਸਿੱਧ ਹੈ ਫਿਰ ਇਸੇ ਤਰ੍ਹਾਂ ਹੀ ਸਾਡੇ ਲਾਗੇ ਇੱਕ ਗੁਰਦਾਸਪੁਰ ਵਿੱਚ ਬੰਦਾ ਸਿੰਘ ਬਹਾਦਰ ਜੀ ਦਾ ਗੁਰਦੁਆਰਾ ਉਹ ਵੀ ਦਿੱਲੀ ਜਾ ਕੇ ਸ਼ਹੀਦ ਹੋਏ ਸੀ ਇਸੇ ਉਹ ਵੀ ਬਹੁਤ ਵਧੀਆ ਮਸ਼ਹੂਰ ਹੈ ਔਰ ਸਾਨੂੰ ਬਹੁਤ ਵਧੀਆ ਇੱਥੇ ਮੰਦਰ ਵੀ ਆ ਕਿਲ੍ਹੇ ਵੀ ਆ ਬਹੁਤ ਅਜਾਇਬ ਘਰ ਹੈ ਅਤੇ ਫਿਰ ਬੱਚੇ ਅਜਾਇਬ ਘਰ ਜਾ ਕੇ ਆਪਣੇ ਗੁਰੂਆਂ ਦੇ ਸੰਬੰਧੀ ਕਿਤਾਬਾਂ ਪੜ੍ਹਦੇ ਉਹਨਾਂ ਵਿੱਚ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਆਪਣੇ ਗੁਰੂਆਂ ਦੇ ਸੰਬੰਧੀ ਕੀ ਕੀ ਜਾਣਕਾਰੀ ਮਿਲਦੀ ਹੈ ਓਕੇ ਥੈਂਕ